ਸਾਡੇ ਧਾਰਮਿਕ ਤਿਉਹਾਰਾਂ ਦੇ ਉੱਤੇ ਜ਼ਿਆਦਾਤਰ ਖਾਣ ਪੀਣ ਦੇ ਵਿੱਚ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਰੋਟੀ ਸਬਜ਼ੀ ਦਾਲ ਖੀਰ ਪ੍ਰਸ਼ਾਦ ਅਤੇ ਜਲ ਦੀ ਸੇਵਾ ਕੀਤੀ ਜਾਂਦੀ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਸਭ ਚੀਜ਼ ਕਰਨ ਦਾ ਬਲ ਬਖਸ਼ਿਆ ਹੈ ਜਦ ਵੀ ਮੱਸਿਆ ਸੰਗਰਾਂਦ ਜਾਂ ਕੋਈ ਗੁਰੂ ਗੁਰੂਆਂ ਦਾ ਤਿੱਥ ਤਿਉਹਾਰ ਜਾਂ ਕੋਈ ਮੇਲਾ ਹੁੰਦਾ ਤਾਂ ਉੱਥੇ ਸਾਰੀ ਸੰਗਤ ਮਿਲ ਕੇ ਲੰਗਰ ਤਿਆਰ ਕਰਦੀ ਹੈ ਬੜੇ ਹੀ ਸ਼ਰਧਾ ਅਤੇ ਭਾਵੁਕ ਨਾਲ ਲੰਗਰ ਤਿਆਰ ਕਰਦੀ ਹੈ ਜਿਸ ਵਿੱਚ ਸਾਰੀ ਸੰਗਤ ਦਾਲ ਰੋਟੀ ਸਬਜ਼ੀ ਖੀਰ ਪ੍ਰਸ਼ਾਦ ਅਤੇ ਜਲ ਦੀ ਸੇਵਾ ਕਰਦੀ ਹੈ ਜਦ ਵੀ ਅਸੀਂ ਆਪਣੇ ਘਰ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਂਦੇ ਹਾਂ ਆਪਾਂ ਘਰ ਵਿੱਚ ਪਾਠ ਜਾਂ ਅਖੰਡ ਪਾਠ ਕਰਵਾਉਂਦੇ ਹਾਂ ਤਾਂ ਅਸੀਂ ਬੜੇ ਹੀ ਚਉ ਨਾਲ ਗੁਰੂ ਸਾਹਿਬਾਨਾਂ ਦਾ ਲੰਗਰ ਤਿਆਰ ਕਰਦੇ ਹਾਂ ਜਿਸ ਦੇ ਵਿੱਚ ਅਸੀਂ ਦਾਲ ਰੋਟੀ ਸਬਜ਼ੀ ਅਤੇ ਖੀਰ ਪ੍ਰਸ਼ਾਦ ਦਾ ਪ੍ਰਸ਼ਾਦ ਅਤੇ ਪਾਣੀ ਦਾ ਪਾਣੀ ਦੀ ਸੇਵਾ ਕਰਦੇ ਹਾਂ ਜਿਸ ਦੇ ਕਰਕੇ ਸਾਨੂੰ ਗੁਰੂ ਸਾਹਿਬਾਨਾਂ ਨੇ ਬਲ ਬਖਸ਼ਿਆ ਹੈ ਅਸੀਂ ਇਹ ਹੀ ਹਰ ਇੱਕ ਤਿਉਹਾਰ 'ਤੇ ਹਰ ਇੱਕ ਗੁਰੂ ਸਾਹਿਬਾਨਾਂ ਦੇ ਹਰ ਇੱਕ ਤਿਉਹਾਰ 'ਤੇ ਚੌਦੇ ਮੱਸਿਆ ਸੰਗਰਾਂਦ ਜਾਂ ਜਨਮ ਦਿਹਾੜਾ ਜਾਂ ਕੋਈ ਮਤਲਬ ਗੁਰੂ ਸਾਹਿਬਾਨਾਂ ਦਾ ਦਿਨ ਦਿਨ ਹੁੰਦਾ ਸਿੱਖੀ ਕੌਮ ਦਾ ਦਿਨ ਹੁੰਦਾ ਉਦੋਂ ਅਸੀਂ ਲੰਗਰ ਦੀ ਹੀ ਵਰਤੋਂ ਕਰਦੇ ਹਾਂ ਇਹੀ ਸਾਡਾ ਬਹੁਤ ਹੀ ਵਧੀਆ ਧਾਰਮਿਕ ਖਾਣ ਪੀਣ ਦਾ ਤਿਉਹਾਰ ਹੈ ਜਿਸ ਨੂੰ ਅਸੀਂ ਬਹੁਤ ਹੀ ਪ੍ਰੇਮ ਅਤੇ ਭਾਵੁਕ ਦੇ ਨਾਲ ਬਣਾ ਕੇ ਸ਼ਰਧਾ ਪੂਰਵਕ ਖਾਂਦੇ ਹਾਂ